ਵੈਸੇ ਤਾਂ ਕਿਸੇ ਦੀ ਉਮਰ ਵਿੱਚ ਪੇਂਟਿੰਗ ਅਤੇ ਡਰਾਇੰਗ ਸਿੱਖ ਸਕਦੇ ਹਾਂ ਪਰ ਇੱਕ ਵਿਦਿਆਰਥੀ ਦੇ ਤੌਰ 'ਤੇ ਮੈਂ ਇਹ ਹੀ ਕਹਾਂਗੀ ਕਿ ਸਾਢੇ ਤਿੰਨ ਤੋਂ ਲੈ ਕੇ ਬਾਰਾਂ ਸਾਲ ਦੀ ਉਮਰ ਤੱਕ ਬੱਚਿਆਂ ਨੂੰ ਪੇਂਟਿੰਗ ਡਰਾਇੰਗ ਸਿੱਖਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਵੈਸੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਉਮਰ ਦੇ ਕਿਸੇ ਪੜਾਅ ਵਿੱਚ ਵੀ ਅਸੀਂ ਪੇਂਟਿੰਗ ਡਰਾਇੰਗ ਸਿੱਖ ਸਕਦੇ ਹਾਂ ਕਜ ਕੁਝ ਮਸ਼ਹੂਰ ਕਲਾਕਾਰ ਅਤੇ ਪੇਂਟਰਸ ਨੇ ਤੀਹ ਚਾਲੀ ਸਾਲ ਦੀ ਉਮਰ ਤੋਂ ਸਿੱਖਣਾ ਸ਼ੁਰੂ ਕੀਤਾ ਅਤੇ ਬਹੁਤ ਸਫਲਤਾ ਹਾਸਿਲ ਕੀਤੀ ਬੱਚੇ ਦੋ ਤਿੰਨ ਸਾਲ ਦੀ ਉਮਰ ਵਿੱਚ ਬ੍ਰੱਸ਼ ਅਤੇ ਪੇਂਟ ਫੈਲਾਉਣਾ ਸਿੱਖ ਜਾਂਦੇ ਹਨ ਵੈਸੇ ਤਾਂ ਸੱਤ ਅੱਠ ਮਹੀਨੇ ਦੇ ਬੱਚੇ ਜੋ ਚੀਜ਼ ਵਿੱਚ ਹੱਥ ਵਿੱਚ ਆਏ ਉਸ ਨਾਲ ਕਾਪੀ 'ਤੇ ਲੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਹਨ ਕੋਈ ਵੀ ਉਮਰ ਹੋਵੇ ਭਾਵੇਂ ਪੱਚੀ ਹੋਵੇ ਜਾਂ ਤੀਹ ਹੋਵੇ ਕਦੇ ਵੀ ਲੇਟ ਨਹੀਂ ਹੁੰਦੀ ਆਰਟ ਐਂਡ ਕਰਾਫਟ ਪੇਂਟਿੰਗ ਕੁਝ ਐਸਾ ਨਹੀਂ ਹੁੰਦਾ ਕਿ ਤੁਸੀਂ ਬਹੁਤ ਲੇਟ ਹੋ ਕਦੇ ਵੀ ਸ਼ੁਰੂ ਕਰ ਸਕਦੇ ਹੋ ਅਤੇ ਆਪਣਾ ਹੁਨਰ ਦਿਖਾ ਸਕਦੇ ਹੋ